ਹੈਲੋ ਹਾਂਜੀ ਗੁਡ ਆਫਟਰਨ ਸਰ ਮੈਂ ਟੂਰਿਸਟ ਮਤਲਬ ਕਿ ਆਉਣਾ ਸੀਗਾ ਕਿ ਵਲ ਕਿ ਕਿਤੇ ਕਿਤੇ ਮਤਲਬ ਕਿ ਮੈਂ ਵਿਜ਼ਿਟ ਕਰਾਂ ਮੈਂ ਤੁਹਾਡੇ ਤੋਂ ਸੁਜੈਸ਼ਨ ਲੈਣੀ ਸੀਗੀ ਤੁਸੀਂ ਹੁਸ਼ਿਆਰਪੁਰ ਤੋਂ ਬੋਲਦੇ ਹੋ ਹੁਣ ਮੈਂ ਜਿਵੇਂ ਕਿ ਲੋਕਲ ਕੋਈ ਜਗ੍ਹਾ 'ਤੇ ਮੈਂ ਘੁੰਮਣਾ ਹੋਵੇ ਮਤਲਬ ਕਿ ਵਿਜ਼ਿਟ ਕਰਨਾ ਹੋਵੇ ਤੁਸੀਂ ਮੈਨੂੰ ਕਿਹੜੀ ਕਿਹੜੀ ਜਗ੍ਹਾ ਮਤਲਬ ਕਿ ਸੁਜੈਸਟ ਕਰੋਂਗੇ ਕਿ ਤੁਸੀਂ ਇੱਥੇ ਜਾਓ ਮੈਨੂੰ ਦੱਸ ਸਕਦੇ ਹੋ ਓਕੇ ਦਾ ਬੈਸਟ ਪਲੇਸ ਇੰਨ ਹੁਸ਼ਿਆਰਪੁਰ ਮਤਲਬ ਕਿ ਜਿਵੇਂ ਤੁਸੀਂ ਕਹੋ ਕਿ ਉੱਥੇ ਜਾਓਂਗੇ ਤਾਂ ਤੁਸੀਂ ਮਤਲਬ ਕਿ ਉਸ ਚੀਜ਼ ਨੂੰ ਯਾਦ ਰੱਖੋਗੇ ਕਿ ਇੱਥੇ ਤੁਸੀਂ ਆਏ ਸੀਗੇ ਹੁਸ਼ਿਆਰਪੁਰ ਦੀ ਖ਼ਾਸ ਜਗ੍ਹਾ ਹੈ ਇਹੋ ਜਿਹੀ ਕਿਹੜੀ ਜਗ੍ਹਾ ਤੁਸੀਂ ਮੈਨੂੰ ਦੱਸ ਸਕਦੇ ਹੋ ਜਿਵੇਂ ਕੋਈ ਬੈਸਟ ਪਲੇਸ ਹੁਸ਼ਿਆਰਪੁਰ ਦੀ ਮਤਲਬ ਕਿ ਤੁਸੀਂ ਜਿਵੇਂ ਮੈਂ ਤੁਹਾਨੂੰ ਪੁੱਛਾਂ ਕਿ ਇਹੋ ਜਿਹੀ ਜਗ੍ਹਾ 'ਤੇ ਹੋਸ਼ਿਆਰਪੁਰ 'ਚ ਮੈਂ ਆਈ ਹਾਂ ਜਿੱਥੇ ਮੈਨੂੰ ਮੈਮਰੇਬਲ ਯਾਦ ਰਹੇ ਕਿ ਹਾਂ ਮੈਂ ਹੁਸ਼ਿਆਰਪੁਰ ਆਈ ਸੀ ਅਤੇ ਮੈਨੂੰ ਆਹ ਜਗ੍ਹਾ ਬਹੁਤ ਵਧੀਆ ਲੱਗੀ ਅਤੇ ਮੈਂ ਇਹਨੂੰ ਯਾਦਗਾਰ ਮੇਰੀ ਮੈਮਰੀ ਰਹੂਗੀ ਇਹੋ ਜਿਹੀ ਕਿਹੜੀ ਤੁਸੀਂ ਜਗ੍ਹਾ ਮਤਲਬ ਕਿ ਸੁਜੈਸਟ ਕਰ ਸਕਦੇ ਹੋ ਕਿ ਕਿੱਥੇ ਜਾ ਕੇ ਇੱਦਾਂ ਦੀ ਮਤਲਬ ਕਿ ਮਹਿਸੂਸ ਹੋਵੇ ਹੁਸ਼ਿਆਪੁਰ ਦੀ ਖ਼ਾਸ ਜਗ੍ਹਾ ਹੈ ਠੀਕ ਆ ਠੀਕ ਆ ਹਾਂ ਕੋਈ ਮਤਲਬ ਕਿ ਕੋਈ ਹੁਸ਼ਿਆਰਪੁਰ ਦੀ ਹਿਸਟੋਰੀਕਲ ਪਲੇਸ ਕੋਈ ਤੁਹਾਨੂੰ ਹੋਵੇ ਕਿ ਹਾਂ ਇਹ ਹਿਸਟੋਰੀਕਲ ਪਲੇਸ ਹੈਗੀ ਆ

ਠੀਕ ਹੈ ਹੋਰ ਕੋਈ ਮਤਲਬ ਕਿ ਤੁਹਾਡੀ ਕੋਈ ਬੈਸਟ ਸੂਜੈਸ਼ਨ ਕੋਈ ਮਤਲਬ ਕਿ ਰਿਲੀਜੀਅਸ ਪਲੇਸ ਦੀ ਗੱਲ ਕੀਤੀ ਜਾਵੇ ਤਾਂ ਹੁਸ਼ਿਆਰਪੁਰ 'ਚ ਕੋਈ ਹੋਰ ਜਿਵੇਂ ਕਿ ਮੰਨ ਲਓ ਕਿ ਮੈਂ ਕੋਈ ਮਤਲਬ ਕਿ ਮਤਲਬ ਕਿ ਕੋਈ ਮੈਨੂੰ ਕਾਰ ਵਗੈਰਾ ਮੈਨੂੰ ਮੈਂ ਆਈ ਹੋਵਾਂ ਅਤੇ ਮੈਂ ਮਤਲਬ ਕਿ ਆਨਲਾਈਨ ਕੋਈ ਮੈਨੂੰ ਮਿਲ ਸਕਦੀ ਹੈ ਮਤਲਬ ਕਿ ਕਾਰ ਜਿਵੇਂ ਕਿ ਆਪਾਂ ਕੈਬ ਵਗੈਰਾ ਕਹਿ ਸਕਦੇ ਹਾਂ ਵਿਜ਼ਿਟ ਦੇ ਲਈ ਓਕੇ ਓਕੇ ਸਰ ਥੈਂਕ ਯੂ ਫੋਰ ਟਾਈਮ